ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਗਜੀਤ ਬੋਲਦੇ ਆ ਹਾਂਜੀ ਹੋਰ ਸੁਣਾਓ ਕੀ ਹਾਲ ਚਾਲ ਜੇ ਅੱਛਾ ਵਧੀਆ ਚਾਹੀਦਾ ਵਧੀਆ ਰੱਖੇ ਹੋਰ ਕਿੱਦਾਂ ਚੱਲਦੀ ਕ੍ਰਾਂਤੀ ਸ਼ਰੰਤੀ ਅੱਜ ਕੱਲ੍ਹ ਹਰੀ ਹਾਂ ਇਹ ਕਿੱਦਾਂ ਰਿਜਲਟ ਰਿਜੁਲਟ ਇਹਨਾਂ ਦੇ ਆ ਨਹੀਂ ਉਹ ਤਾਂ ਜਦੋਂ ਦੇਸ਼ ਆਜ਼ਾਦ ਹੋਇਆ ਸੀ ਨਾ ਉਦੋਂ ਹਰੀ ਕ੍ਰਾਂਤੀ ਜਿਹੜੀ ਆਈ ਸੀ ਨਾ ਉਦੋਂ ਬਹੁਤ ਸਰਕਾਰ ਨੇ ਜ਼ੋਰ ਲਗਾਇਆ ਸੀ ਹਰੀ ਕ੍ਰਾਂਤੀ ਦੇ ਟੋਪਿਕ 'ਤੇ ਇਹ ਆ ਵੀ ਚਲੋ ਫ਼ਸਲਾਂ ਫ਼ਸਲਾਂ ਫੁਸਲਾਂ ਹਾਂਜੀ ਹਾਂਜੀ ਚਲੋ ਸਾਰਿਆਂ ਨੂੰ ਆਪਣਾ ਅਨਾਜ ਖਾਣ ਵਾਸਤੇ ਉਹ ਫਿਰ ਤੁਹਾਨੂੰ ਪਤਾ ਫਿਰ ਉੱਧਰ ਤੁਹਾਡੇ ਵਧੀਆ ਦਵਾਈਆਂ ਦਵੂਈਆ ਪੈ ਕੇ ਥੋੜ੍ਹਾ ਬਹੁਤਾ ਫਰਕ ਤਾਂ ਪੈਂਦਾ ਹੀ ਹੈ ਨਾ ਆ ਇਹ ਤਾਂ ਗੱਲ ਇਸ ਤਰ੍ਹਾਂ ਹੀ ਹੁੰਦੀ ਆ

ਆਹੋ ਜੇ ਕੋਈ ਹਰੀ ਕ੍ਰਾਂਤੀ ਨਾ ਇਹ ਵੀ ਜਿਹੜਾ ਅਸੀਂ ਬਾਹਰੋਂ ਅਨਾਜ ਲੈਂਦੇ ਹਾਂ ਨਾ ਉਹ ਸਾਡਾ ਇਹ ਹੈ ਵੀ ਸਾਨੂੰ ਉਹ ਨੀ ਲੈਣਾ ਪੈਣ ਡਿਆ ਵੀ ਚਲੋ ਸਾਡੀ ਦੇਸ਼ ਦੀ ਧਰਤੀ ਬਹੁਤ ਵਧੀਆ ਵਾ ਅਨਕੂਲ ਮੌਸਮ ਹੈ ਇੱਥੋਂ ਦਾ ਆਹੋ ਇਹ ਤਾਂ ਗੱਲ ਹੈਗੀ ਹੈ ਚਲੋ ਪਹਿਲਾਂ ਤਾਂ ਨਹੀਂ ਕੋਈ ਚੱਕਰ ਹੈਗਾ ਬਾਅਦ 'ਚ ਜਦੋਂ ਦੇ ਦਵਾਈਆਂ 'ਚ

ਹਾਂਜੀ ਹਾਂਜੀ ਆ ਇਹ ਤਾਂ ਗੱਲ ਠੀਕ ਹੈ ਤੁਹਾਡੀ ਚਲੋ ਮਹਾਰਾਜ ਹਾਂ ਹਾਂਜੀ ਹਾਂਜੀ ਵਧੀਆ ਭਾਅ ਜੀ ਵਧੀਆ ਵਧੀਆ ਰਾਜੀ ਖੁਸ਼ੀ ਠੀਕ ਹੈ ਭਾਅ ਜੀ ਠੀਕ ਹੈ ਓਕੇ